ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਤੁਸੀਂ ਸਤਿਨੂਰ ਟਰਾਂਸਪੋਰਟ ਤੋਂ ਗੱਲ ਕਰ ਰਹੇ ਹੋ ਮੈਂ ਤੁਹਾਡੇ ਨੇੜੇ ਹੀ ਪਿੰਡ ਘੁੱਦਾ ਤੋਂ ਗੱਲ ਕਰ ਰਹੀ ਹਾਂ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਮੈਂ ਤੁਹਾਡੇ ਕੋਲੋਂ ਇੱਕ ਕੈਬ ਬੁੱਕ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਂ ਅਤੇ ਮੇਰੀ ਪੂਰੀ ਫੈਮਿਲੀ ਇੱਕ ਟ੍ਰਿਪ ਪਲੈਨ ਕਰ ਰਹੇ ਹਾਂ ਜਿਸ ਲਈ ਸਾਨੂੰ ਇੱਕ ਕੈਬ ਦੀ ਲੋੜ ਹੈ ਜਿਸ ਵਿੱਚ ਏ ਸੀ ਅਤੇ ਕੰਫਰਟੇਬਲ ਸੀਟ ਹੈ ਜਿਹੜੀਆਂ ਉਪਲੱਬਧ ਹੋਣ ਸਾਨੂੰ ਸੱਤ ਸੀਟਰ ਗੱਡੀ ਚਾਹੀਦੀ ਹੈ ਕਿਉਂਕਿ ਮੇਰੀ ਫੈਮਿਲੀ ਦੇ ਵਿੱਚ ਸੱਤ ਮੈਂਬਰ ਹਨ ਇਸ ਲਈ ਮੈਨੂੰ ਤੁਸੀਂ ਜਲਦੀ ਤੋਂ ਜਲਦੀ ਪ ਘੱਟ ਤੋਂ ਘੱਟ ਰੇਟ ਵਾਲੀ ਕੈਬ ਦੱਸ ਦਿਓ ਅਤੇ ਜੇਕਰ ਤੁਸੀਂ ਗ ਅੱਧਾ ਕਿਰਾਇਆ ਪਹਿਲਾਂ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਗੂਗਲ ਪੇਅ ਨੰਬਰ ਸੈਂਡ ਕਰ ਦਿਓ ਅਤੇ ਸਾਨੂੰ ਸਾਨੂੰ ਡਰਾਈਵਰ ਐਕਸਪੀਰੀਅੰਸ ਚਾਹੀਦਾ ਹੈ ਜੇ ਜਿਹੜੇ ਕੇ ਸਾਨੂੰ ਵਧੀਆ ਉੱਥੋਂ ਦੀ ਸਾਰੀ ਚੀਜ਼ਾਂ ਦਿਖਾ ਕੇ ਲਿਆਵੇ ਕਿਉਂਕਿ ਅਸੀਂ ਫਤਿਹਗੜ੍ਹ ਸਾਹਿਬ ਗੁਰਦੁਆਰਾ ਦਾ ਆਪਣਾ ਟ੍ਰਿਪ ਪਲਾਨ ਕਰ ਰਹੇ ਹਾਂ ਜਿਸ ਲਈ ਸਾਨੂੰ ਇੱਕ ਵਧੀਆ ਡਰਾਈਵਰ ਦੀ ਲੋੜ ਹੈ ਧੰਨਵਾਦ ਤੁਸੀਂ ਸਾਨੂੰ ਘੱਟ ਤੋਂ ਘੱਟ ਰੇਟ ਦੇ ਵਿੱਚ ਕੈਬ ਬੁੱਕ ਕਰ ਦਿਓ ਧੰਨਵਾਦ